ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਅੱਜ ਕੱਲ੍ਹ ਦੇ ਮੌਸਮ ਬਹੁਤ ਖਰਾਬ ਹੈ ਗਰਮੀ ਵਾਲਾ ਮੌਸਮ ਹੈ ਇਸ ਕਰਕੇ ਮੈਂ ਘਰ ਆਪਣੇ ਪੇੜ ਪੌਦੇ ਲਗਾਏ ਹਨ ਫੁੱਲ ਲਗਾਏ ਹਨ ਜਿਨ੍ਹਾਂ ਨੂੰ ਮੈਂ ਦੋ ਟਾਈਮ ਪਾਣੀ ਦਿੰਦੀ ਹਾਂ ਘਰ ਵਿੱਚ ਮੈਂ ਸਬਜ਼ੀਆਂ ਵੀ ਲਗਾਈਆਂ ਹਨ ਕਾਲੀ ਤੋਰੀ ਲਾਈ ਭਿੰਡੀਆਂ ਲਾਈਆਂ ਹੋਰ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਹਨ ਜਿਨ੍ਹਾਂ ਨੂੰ ਦੋ ਟਾਈਮ ਪਾਣੀ ਦਈਦਾ ਅਤੇ ਉਹਨਾਂ ਉਹਨਾਂ 'ਤੇ ਛਾਂ ਦਾ ਵੀ ਕਾਫੀ ਪ੍ਰਬੰਧ ਕੀਤਾ ਹੋਇਆ ਬਜ਼ਾਰ ਵਿੱਚ ਸਬਜ਼ੀਆਂ ਦਾ ਤਾਂ ਬਹੁਤ ਮਾੜਾ ਹਾਲ ਆ ਉਹਨਾਂ ਨੇ ਖਾਦਾਂ ਖੂਦਾਂ ਸਭ ਪਾਈਆਂ ਹੋਈਆਂ ਹੁੰਦੀਆਂ ਹਨ ਅਤੇ ਜਿਹੜੀਆਂ ਸਾਡੇ ਸਰੀਰ ਨੂੰ ਬਹੁਤ ਮਾੜੀਆਂ ਲੱਗਦੀਆਂ ਹਨ ਬੱਚਿਆਂ ਨੂੰ ਵੀ ਮਾੜੀਆਂ ਲੱਗਦੀਆਂ ਹਨ ਬੱਚੇ ਖਾਣਾ ਪਸੰਦ ਨਹੀਂ ਕਰਦੇ ਬਾਹਰ ਦੀਆਂ ਸਬਜ਼ੀਆਂ ਇਸ ਕਰਕੇ ਮੈਂ ਸਾਰਾ ਕੁਛ ਘਰ ਹੀ ਉਗਾਇਆ ਹੋਇਆ ਆਪਣੇ ਪਿੱਛੇ ਬੈਕ 'ਤੇ ਆਪਣੀ ਸ ਬਣਾ ਕੇ ਕਿਆਰੀਆਂ ਬਣਾ ਕੇ ਆਪਣੇ ਘਰ ਹੀ ਸਾਰਾ ਫੁੱਲ ਬੂਟੇ ਲਗਾਏ ਸਬਜ਼ੀਆਂ ਲਗਾਈਆਂ ਹਨ ਵੱਖ ਵੱਖ ਤਰ੍ਹਾਂ ਦੀਆਂ ਜਿਨ੍ਹਾਂ 'ਤੇ ਅਸੀਂ ਘਰ ਹੀ ਸਾਰਾ ਕੁਛ ਆਪਣੇ ਖਾਦ ਪਾਉਂਦੇ ਹਾਂ ਰੂੜੀ ਪਾਉਂਦੇ ਹਾਂ ਉਹਨਾਂ ਨਾਲ ਸ ਸਾਨੂੰ ਸਭ ਕੁਛ ਜਿਹੜਾ ਵਧੀਆ ਲੱਗਦਾ ਹੈ ਸਬਜ਼ੀਆਂ ਦਾ ਵੀ ਗਰਮੀਆਂ 'ਚ ਦੋ ਟਾਈਮ ਪਾਣੀ ਪਾਈਦਾ ਸਰਦੀਆਂ 'ਚ ਇੱਕ ਟਾਈਮ ਪਾਣੀ ਪਾਈਦਾ ਤਾਂ ਕਿ ਧੁੱਪ ਕਰਕੇ ਫੁੱਲ ਬੂਟਾ ਬਹੁਤ ਸੋਹਣਾ ਹੁੰਦਾ ਇਸ ਕਰਕੇ ਅੱਜ ਕੱਲ੍ਹ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਕੰਮ ਖਰਾਬ ਹੋ ਰਿਹਾ ਫੁੱਲ ਤਾਂ ਵੈਸੇ ਵੀ ਲਗਾਓ ਤਾਂ ਉਸ ਉਸ ਵੇਲੇ ਸੁੱਕ ਜਾਂਦੇ ਆ ਦੋ ਦਿਨ ਬਾਅਦ ਪਾਣੀ ਪਾਓ ਤਾਂ ਵੈਸੇ ਸੁੱਕ ਜਾਂਦੇ ਆ ਸਰਦੀਆਂ ਵਿੱਚ ਤਾਂ ਦੋ ਦਿਨ ਪਾਣੀ ਨਾ ਵੀ ਪਾਓ ਫਿਰ ਵੀ ਬਹੁਤ ਵਧੀਆ ਰਹਿੰਦਾ